ਪੰਜਾਬੀ ਭਾਸ਼ਾ ਦੀ ਬਹੁਤ ਥਾਵਾਂ 'ਤੇ ਕੀਤੀ ਜਾਂਦੀ ਹੈ ਜਿਵੇਂ ਕਿ ਸਾਡੀ ਪੰਜਾਬੀ ਭਾਸ਼ਾ ਮਾਂ ਬੋਲੀ ਹੈ ਸਾਡੇ ਇੱਥੇ ਪੰਜਾਬ ਵਿੱਚ ਹਰ ਥਾਂ 'ਤੇ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਕਿਉਂਕਿ ਵੈਹ ਪੰਜਾਬੀ ਭਾਸ਼ਾ ਤੋਂ ਹੀ ਸਾਡੀ ਮਾਂ ਬੋਲੀ ਦਾ ਪਤਾ ਲੱਗਦਾ ਹੈ ਅਤੇ ਸਾਡੀ ਜਾਣਕਾਰੀ ਦਾ ਪਤਾ ਲੱਗਦਾ ਹੈ ਕਿਉਂਕਿ ਆਪਾਂ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਕਿਵੇਂ ਆਪਾਂ ਪੰਜਾਬ ਵਿੱਚ ਆਪਣੀ ਮਾਂ ਬੋਲੀ ਨੂੰ ਬੋਲਦੇ ਹਨ ਹੁਣ ਸਾਡੇ ਇੱਥੇ ਬਹੁਤ ਸਾਰੇ ਜਿਵੇਂ ਕਿ ਇੰਗਲੈਂਡ ਤੋਂ ਕਈ ਵੀ ਵਿਅਕਤੀ ਆ ਜਾਂਦਾ ਹੈ ਅਤੇ ਉਹ ਆਪ ਸਾਡੇ ਨਾਲ ਆਪਣੀ ਭਾਸ਼ਾ ਨੂੰ ਬੋਲਦਾ ਹੈ ਅਤੇ ਲੇਕਿਨ ਉਹਨਾਂ ਦੀ ਭਾਸ਼ਾ ਸਾਨੂੰ ਖਾਸ ਤੌਰ 'ਤੇ ਇੰਨੀ ਨਹੀਂ ਸਮਝ ਨਹੀਂ ਆਉਂਦੀ ਕਿਉਂਕਿ ਸਾਡੀ ਪੰਜਾਬੀ ਭਾਸ਼ਾ ਹੀ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਇਸ ਨੂੰ ਵਰਤਣ ਦੀ ਬਹੁਤ ਹੀ ਲੋੜ ਹੈ ਅਤੇ ਸਾਡੀ ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਹੈ ਜਿਵੇਂ ਕਿ ਪੰਜਾਬੀ ਭਾਸ਼ਾ ਵਿੱਚ ਬਹੁਤ ਸਾਰੇ ਹਨ ਜਿਵੇਂ ਟਿੱਪਣੀਆਂ ਵਗੈਰਾ ਬਹੁਤ ਸਾਰੀਆਂ ਚੀਜ਼ਾਂ ਹਨ ਸਾਡੇ ਪੰਜਾਬੀ ਲੋਕ ਨਾਚ ਵਿੱਚ ਬਹੁਤ ਸਾਰੇ ਜਿਵੇਂ ਲੋਕ ਭੰਗੜੇ ਦੇ ਬਹੁਤ ਸ਼ੌਕੀਨ ਹਨ ਹੋਰ ਵੀ ਭੰਗੜਾ ਗਿੱਧਾ ਕੁੜੀਆਂ ਦਾ ਸਭ ਤੋਂ ਫੇਮਸ ਚੀਜ਼ ਹੈ ਜੋ ਕਿ ਉਹ ਹਰ ਫੈਸਟੀਵਲ ਵਗੈਰਾ 'ਤੇ ਸਾਡੇ ਸਕੂਲ ਵਿੱਚ ਕਈ ਫੈਸਟੀਵਲ ਵੀ ਹੁੰਦੇ ਹਨ ਜਿਵੇਂ ਕਿ ਉਹਦੇ ਵਿੱਚ ਲੋਕ ਗਿੱਧਾ ਭੰਗੜਾ ਵਗੈਰਾ ਪਾਉਂਦੇ ਸਨ ਮੈਂ ਵੀ ਆਪਣੇ ਟੀਮ ਦਾ ਇੱਕ ਭੰਗੜੇ ਦਾ ਖਿਡਾਰੀ ਹਾਂ ਜੋ ਕਿ ਮੈਨੂੰ ਭੰਗੜੇ ਦਾ ਬਹੁਤ ਸ਼ੌਂਕ ਹੈ ਸਾਡੇ ਕੋਚ ਸਾਹਿਬ ਸਾਨੂੰ ਭੰਗੜਾ ਸਿਖਾਉਂਦੇ ਸਨ ਜੋ ਕਿ ਆਪਾਂ ਭੰਗੜਾ ਪਾ ਕੇ ਕਰਦੇ ਸਨ ਅਤੇ ਭੰਗੜਾ ਬਹੁਤ ਹੀ ਵਧੀਆ ਪਾਉਂਦੇ ਹਨ ਅਤੇ ਇਸੇ ਤਰ੍ਹਾਂ ਪੰਜਾਬੀ ਦੇ ਬਹੁਤ ਸਾਰੇ ਹੋਰ ਵੀ ਚੀਜ਼ਾਂ ਹਨ ਜੋ ਕਿ ਪੰਜਾਬੀ ਲੋਕ ਕਰਦੇ ਹਨ ਅਤੇ ਪੰਜਾਬੀ ਸਾਡੀ ਇੱਕ ਮਾਂ ਬੋਲੀ ਹੈ ਅਤੇ ਸਾਨੂੰ ਪੰਜਾਬੀ ਦੀ ਕਵਿਤਾ ਵੀ ਪੰਜਾਬੀ ਵਿੱਚ ਬਹੁਤ ਸਾਰੇ ਕਵਿਤਾ ਵੀ ਹਨ ਜਿਵੇਂ ਮਾੜਾ ਬੰਦਾ ਵਗੈਰਾ ਚੀਜ਼ਾਂ ਬਹੁਤ ਸਾਰੀਆਂ ਹੋਰ ਵੀ ਕਵਿਤਾਵਾਂ ਹਨ ਜਿੰਨਾਂ ਦੀ ਮੈਂ ਅਲੋਚਨਾ ਨਹੀਂ ਕਰ ਸਕਦਾ ਇਸ ਕਰਕੇ ਪੰਜਾਬੀ ਨੂੰ ਸਾਨੂੰ ਅਪਣਾਉਣਾ ਚਾਹੀਦਾ ਹੈ ਅਤੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਸਮਝਣਾ ਚਾਹੀਦਾ